ਸਾਡੇ ਏਰੀਏ 'ਚ ਲੋਕ ਬੱਚੇ ਵਿਦਿਆਰਥੀ ਬੀ ਟੈਕ ਕਰਦੇ ਹਨ ਬੀ ਟੈਕ ਦੇ ਅਲੱਗ ਅਲੱਗ ਟਰੇਡਾਂ ਮੈਕਨੀਕਲ ਇੰਜੀਨੀਅਰ ਆਟੋਮੋਬਾਇਲ ਇੰਜੀਨੀਅਰ ਸਿਵਲ ਇੰਜੀਨੀਅਰ ਇਲੈਕਟ੍ਰੋਨਿਕਸ ਐਂਡ ਕਮਿਉਨੀਕੇਸ਼ਨ ਇੰਜੀਨੀਅਰ ਇਲੈਕਟ੍ਰੀਕਲ ਇੰਜੀਨੀਅਰ ਦੇ ਕੋਰਸ ਕਰਵਾਏ ਜਾਂਦੇ ਹਨ